ਪਰਮਾਤਮਾ ਦੀ ਰਚੀ ਇਸ ਸ੍ਰਿਸ਼ਟੀ 'ਚ ਮਨੁੱਖ ਰੋਜ਼ ਹੀ ਕੋਈ ਨਾ ਕੋਈ ਖੋਜ ਕਰਦਾ ਹੈ ਬ੍ਰਹਿਮੰਡ ਦੀ ਬਣਤਰ ਅਤੇ ਵਿਕਾਸ ਬਾਰੇ ਮਨੁੱਖ ਰੋਜ਼ ਕੋਈ ਨਾ ਕੋਈ ਨਵੀਂ ਦਲੀਲ ਪੇਸ਼ ਕਰ ਰਿਹਾ ਹੈ ਜਿਵੇਂ ਕਿ ਹਾਲ ਹੀ ਵਿੱਚ ਇੱਕ ਉਲਕਾ ਪਿੰਡ ਧਰਤੀ ਵੱਲ ਤੇਜ਼ੀ ਨਾਲ ਆ ਰਿਹਾ ਹੈ ਅਤੇ ਦੋ ਹਜ਼ਾਰ ਸਤਾਈ ਦੇ ਜਨਵਰੀ ਮਹੀਨੇ 'ਚ ਧਰਤੀ ਦੇ ਕੋਲੋਂ ਦੀ ਨਿਕਲੇਗਾ ਇਹ ਵਿਗਿਆਨੀਆਂ ਦੀ ਖੋਜ ਦਾ ਮਾਨੋ ਨਿੱਕਾ ਜਿਹਾ ਹਿੱਸਾ ਹੈ ਮਨੁੱਖ ਵਿਗਿਆਨ ਦੀ ਮਦਦ ਨਾਲ ਚੰਦਰਮਾ ਸਮੇਤ ਅਨੇਕਾਂ ਗ੍ਰਹਿਆਂ ਦੀ ਜਾਣਕਾਰੀ ਪ੍ਰਾਪਤ ਕਰਨ 'ਚ ਜੁਟਿਆ ਹੋਇਆ ਹੈ ਅਖੀਰ ਸੱਚਾਈ ਇਹ ਹੀ ਹੈ ਕਿ ਜਿੰਨੇ ਮਰਜ਼ੀ ਸਾਲ ਬੀਤ ਜਾਣ ਜਿੰਨੇ ਮਰਜ਼ੀ ਵਿਗਿਆਨੀ ਜਨਮ ਲੈ ਲੈਣ ਜਿੰਨੇ ਮਰਜ਼ੀ ਖੋਜਾਂ ਦੇ ਪ੍ਰਬੰਧ ਹੋ ਜਾਣ ਪਰ ਪਰਮਾਤਮਾ ਦੀ ਬਣਾਈ ਅਥਾਹ ਦੁਨੀਆਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਸ ਕਰਕੇ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਬਾਣੀ 'ਚ ਕਹਿ ਗਏ ਹਨ ਧਰਤੀ ਹੋਰ ਪਰੇ ਹੋਰ ਹੋਰ ਇਸ ਮਹਾਂ ਵਾਕ ਅਨੁਸਾਰ ਜਿੰਨਾ ਮਰਜ਼ੀ ਬੰਦਾ ਅੰਤ ਪਾਉਣ ਦੀ ਕੋਸ਼ਿਸ਼ ਕਰੇ ਪਰ ਅਥਾਹ ਪਰੇ ਤੋਂ ਪਰੇ ਵਸ ਵਸੀ ਹੋਈ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ ਹੈ ਧੰਨਵਾਦ